ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਭਾਅ ਜੀ ਠੀਕ ਹੈ ਠੀਕ ਹੈ ਭਾਅ ਜੀ ਪਛਾਣ ਮੈਂ ਲਿਆ ਭਾਅ ਜੀ ਠੀਕ ਹੈ ਜੀ ਠੀਕ ਹੈ ਆਪਣਾ ਜਿਹੜਾ ਡੀ ਏ ਵੀ ਕਾਲਜ ਅੱਛਾ ਜੀ ਹਾਂਜੀ ਹਾਂਜੀ ਭਾਅ ਜੀ ਪੀਜੀ ਵਾਧੂ ਹੈਗੇ ਇਥੇ ਮਿਲ ਜਾਣਗੇ ਪੀ ਜੀ ਤਾਂ ਤਾਂ ਮੈਨੂੰ ਵੀ ਦੱਸਿਆ ਸੀਗਾ ਰਮਨ ਭਾਅ ਜੀ ਨੇ ਵੀ ਰਹਿਣਾ ਹੈਗਾ ਤੁਸੀਂ ਤੇ ਮੈਂ ਪਹਿਲਾਂ ਤਾਂ ਹੀ ਦੇਖ ਰਿਹਾ ਤਾਂ ਪੀ ਜੀ ਪਰ ਮੈਨੂੰ ਥੋੜਾ ਜਿਹਾ ਇਹ ਦੱਸ ਦੋ ਕਿ ਬਜਟ ਬੁਜਟ ਆਪਣਾ ਕੀ ਹੈਗਾ ਜੀ ਭਾਅ ਜੀ ਐ ਨਾ ਆਪਾਂ ਨੂੰ ਫਿਰ ਅਨਫੋਰਨਸਿਡ ਵੀ ਮਿਲ ਜਾਊਗਾ ਫਰਨਿਸ਼ਟ ਮਿਲ ਜੂਗਾ ਉਹ ਤੁਹਾਡੀ ਰਿਕਵਾਇਰਮੈਂਟ ਦੇ ਹਿਸਾਬ ਨਾਲ ਹਨਾ ਕਿ ਤੁਸੀਂ ਕਿੱਦਾਂ ਲੈਣਾ ਹੈਗਾ ਜਾਂ ਫੂਡ ਵਿੱਚ ਇੰਨਕਲਿਊਡਡ ਲੈਣਾ ਜਾਂ ਬਿਨਾਂ ਫੂਡ ਤੇ ਕਿੱਦਾਂ ਜੀ ਜੇ ਤਾਂ ਭਾਅ ਜੀ ਵਿੱਚ ਫਰਨੀਚਰ ਹੈਗਾ ਤੇ ਜੇ ਇਕੱਲਾ ਰੂਮ ਲੈਣਾ ਹੈਗਾ ਤਾਂ ਤਾ ਭਾਅ ਜੀ ਹੈਗਾ ਬਾਰਾਂ ਹਜਾਰ ਰੁਪਈਆ ਤੇ ਜੇ ਅਨਫੋਰਨਿਸਟ ਹੈਗਾ ਤਾਂ ਉਹੀ ਚਾਰ ਕੁ ਹਜਾਰ ਰੁਪਈਆਂ ਘੱਟ ਜਾਣਾ ਭਾਅ ਥੋਡਾ ਅੱਠ ਹਜਾਰ ਰੁਪਈਆ ਉਹ ਭਾ ਭਾਅ ਜੀ ਫੂਡ ਦੇ ਦੋ ਹਜਾਰ ਰੁਪਈਆ ਅਲੱਗ ਤੋਂ ਐਕਸਟਰਾ ਹੈਗਾ ਆਪਾਂ ਜੀ ਜੇ ਤੁਸੀਂ ਇੰਕਲੂਡਿਡ ਰੱਖਣਾ ਹਨਾ ਫਿਰ ਤਾਂ ਤੁਹਾਨੂੰ ਪੀਜੀ 'ਚ ਮਿਲੂਗਾ ਸਵੇਰੇ ਬਰੇਕਫਾਸਟ ਮਿਲ ਜਿਆ ਕਰੂਗਾ ਦੁਪਹਿਰੇ ਲੰਚ ਵੀ ਤੁਹਾਨੂੰ ਬਣਿਆ ਮਿਲ ਜੇਗਾ ਡਿਨਰ ਵੀ ਮਿਲ ਜੂਗਾ ਹਨਾ ਸਾਰਾ ਕੁਝ ਕੋਈ ਦਿੱਕਤ ਆਲੀ ਗੱਲ ਨੀ ਹੈਗੀ ਵਧੀਆ ਫੂਡ ਦਿੰਦੇ ਭਾਅ ਜੀ ਤੇ ਜੇ ਤੁਸੀਂ ਆਪਣਾ ਹਨਾ ਕੀ ਬਾਹਰੋਂ ਖਾ ਸਕਦੇ ਆ ਵੀ ਤੁਹਾਡੇ ਕੋਲ ਹੈਗਾ ਕੋਈ ਹੋਰ ਸਾਧਨ ਫਿਰ ਆਪਣਾ ਚਲੋ ਤੁਸੀਂ ਦੇਖ ਲਿਓ ਹਨਾ ਜਿੱਦਾਂ ਵੀ ਤੁਹਾਨੂੰ ਸਹੀ ਲੱਗਿਆ ਅਨ ਫਰਨਿਸ਼ਡ ਦੇ ਵਿੱਚ ਫੂਡ ਕਰਨਾ ਹਨਾ ਜੀ ਉਹਦਾ ਭਾਅ ਜੀ ਮੈਂ ਤੁਹਾਨੂੰ ਅੱਠ ਹਜਾਰ ਦੱਸਿਆ ਸੀਗਾ ਦੋ ਹਜਾਰ ਰੁਪਈਆ ਵਿੱਚ ਫੂਡ ਪਾ ਕੇ ਹਨਾ ਜੀ ਦਸ ਹਜਾਰ ਰੁਪਈਆ ਹੋ ਗਿਆ ਭਾਈ ਤੁਹਾਡਾ ਤੇ ਐਦ ਜੇ ਭਾਅ ਜੀ ਸ਼ੇਅਰ ਕਰਨਾ ਫਿਰ ਇਦਾਂ ਰੂਮ ਦਾ ਕਿਰਾਇਆ ਅੱਠ ਹਜਾਰ ਆ ਉਹ ਤੁਹਾਡਾ ਅੱਧਾ ਹੋ ਜਾਣਾ ਨਾ ਉਹ ਚਾਰ ਹਜਾਰ ਉਹ ਹੋ ਜਾਣਾ ਹੈਗਾ ਫੂਡ ਦਾ ਵਿੱਚ ਰਹਿਣਾ ਹੀ ਹ ਦੋ ਹਜਾਰ ਰੁਪਈਆ ਓ ਛੇ ਹਜਾਰ ਰੁਪਈਆ ਹਾਂਜੀ ਹਾਂਜੀ ਛੇ ਹਜਾਰ ਰੁਪਈਆ ਭਾਅ ਜੀ ਫਿਰ ਹੋ ਜਾਣਾ ਥੋਡਾ ਤੇ ਬਾਕੀ ਭਾਅ ਜੀ ਮੈਨੂੰ ਹਾਂਜੀ ਹਾਂਜੀ ਹਾਂ ਹਾਂ ਭਾਅ ਜੀ ਅਵੇਲੇਬਲ ਹੈਗੇ ਆ ਤੇ ਤੁਸੀਂ ਨਾ ਮੈਨੂੰ ਇੱਕ ਵਾਰ ਫੋਨ ਕਰ ਦਿਓ ਮੈਂ ਤੁਹਾਨੂੰ ਫੋਟੋਆਂ ਵੀ ਭੇਜ ਦੂਗਾ ਹਨਾ ਮਤਲਬ ਜਦ ਵੀ ਤੁਸੀਂ ਠੀਕ ਆ ਭਾਅ ਜੀ ਮੈਂ ਫੋਟੋਆਂ ਵੀ ਪਾ ਦੂਗਾ ਬਾਕੀ ਅਸੀਂ ਆ ਸਕਦੇ ਹੋਏ ਤਾਂ ਇੱਕ ਵਾਰ ਆ ਕੇ ਮੇਰੇ ਨਾਲ ਦੇਖ ਹੀ ਲਿਓ ਘੁੰਮ ਫਿਰ ਕੇ ਵੀ ਜਿਹੜਾ ਤੁਹਾਨੂੰ ਸਾਰਿਆਂ ਤੋਂ ਚੰਗਾ ਲੱਗਿਆ ਉੱਥੇ ਆਣਾ ਲੈ ਲਿਓ ਠੀਕ ਐ ਭਾਅ ਜੀ ਠੀਕ ਐ ਜੀ